ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਲਈ ਮੈਨੂੰ ਲੱਗਦਾ ਕਿ ਘਰਾਂ ਦੇ ਵਿੱਚ ਸਫਾਈ ਜ਼ਿਆਦਾ ਹੋਣੀ ਚਾਹੀਦੀ ਆ ਔਰ ਇੱਕ ਰੋਜ਼ ਸ਼ਾਮ ਨੂੰ ਜਿਹੜਾ ਹੈ ਨਿੰਮ ਦੇ ਪੱਤੇ ਅ ਸੁਣਿਆ ਸੀਗਾ ਜਾਂ ਕਰਦੇ ਵੀ ਹਾਂ ਘਰਾਂ ਦੇ ਵਿੱਚ ਕਿ ਨਿੰਮ ਦੇ ਪੱਤਿਆਂ ਨੂੰ ਵਾਟੇ ਦੇ ਵਿੱਚ ਇਕੱਠੇ ਕਰਕੇ ਅਤੇ ਜਲਾ ਦਿੰਦੇ ਹਾਂ ਤਾਂ ਉਹਦੇ ਨਾਲ ਘਰ ਜਿਹੜਾ ਫਰੈਸ਼ ਹੋ ਜਾਂਦਾ ਔਰ ਨਿੰਮ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਯੂਜ ਕੀਤੀ ਜਾਵੇ ਉਹ ਚੰਗੀ ਹੁੰਦੀ ਹੈ ਕਰ ਕਰਨ ਦੇ ਵਿੱਚ ਬਾਕੀ ਕਪੂਰ ਨੂੰ ਜਿਹੜਾ ਉਹ ਤੁਸੀਂ ਜਦੋਂ ਘਰ ਰੱਖਦੇ ਹੋ ਬਾਲਦੇ ਹੋ ਤਾਂ ਉਹਦੀ ਫਰੈਗ ਦੇ ਨਾਲ ਜਿੰਨੇ ਵੀ ਆ ਮੱਛਰ ਵਗੈਰਾ ਉਹ ਘਰਾਂ 'ਚ ਨਹੀਂ ਰਹਿੰਦੇ ਜਿੰਨੀ ਸਾਫ਼ ਸਫਾਈ ਹੋਏਗੀ ਉਨਾ ਹੀ ਚੰਗਾ ਹੋਏਗਾ ਉਨਾ ਹੀ ਘਰਾਂ ਦੇ ਵਿੱਚ ਇੱਦਾਂ ਦੀਆਂ ਬਿਮਾਰੀਆਂ ਨਹੀਂ ਹੋਣਗੀਆਂ ਹੱਥ ਧੋ ਕੇ ਖਾਣਾ ਖਾਓ ਬਣਾਓ ਔਰ ਬੱਚਿਆਂ ਨੂੰ ਵੀ ਇਹ ਹੀ ਸਿਖਾਈ ਦਾ ਕਿ ਜਦੋਂ ਵੀ ਖਾਣਾ ਖਾਣਾ ਉਸ ਤੋਂ ਪਹਿਲਾਂ ਹੱਥ ਧੋਤੇ ਹੋਣੇ ਚਾਹੀਦੇ ਆ ਸਾਫ਼ ਕੱਪੜੇ ਪਹਿਨੋ ਔਰ ਸਾਫ਼ ਕੱਪੜੇ ਪਹਿਨੋਂਗੇ ਤਾਂ ਉਹਦੇ ਵਿੱਚ ਵੀ ਕੋਈ ਮਤਲਬ ਜਦੋਂ ਉਹਨਾਂ ਨੂੰ ਕੱਪੜਿਆਂ ਨੂੰ ਧੋਂਦੇ ਹੋ ਉਦੋਂ ਵੀ ਨਿੰਮ ਦੇ ਪੱਤੇ ਜਿਹੜੇ ਆ ਉਹਦੇ ਵਿੱਚ ਪਾ ਲਉ ਤਾਂ ਜ਼ਿਆਦਾ ਵਧੀਆ ਜਦੋਂ ਨਿੰਮ ਦੇ ਜਦੋਂ ਅਲਮੀਰਾਸ ਦੇ ਵਿੱਚ ਕੱਪੜੇ ਵਗੈਰਾ ਰੱਖਦੇ ਹਾਂ ਤਾਂ ਉਦੋਂ ਵੀ ਉਹਨਾਂ ਕੱਪੜਿਆਂ ਦੇ ਵਿੱਚ ਨਿੰਮ ਦੇ ਪੱਤੇ ਹੋਣੇ ਚਾਹੀਦੇ ਆ ਜਿੰਨਾ ਜ਼ਿਆਦਾ ਨਿੰਮ ਨੂੰ ਯੂਜ਼ ਕਰਾਂਗੇ ਉਨਾ ਜ਼ਿਆਦਾ ਆਪਣੀ ਹੈਲਥ ਜਿਹੜੀ ਉਹ ਸਹੀ ਰਹੇਗੀ ਬਾਕੀ ਆਪਣੀ ਡਾਇਟ ਵਗੈਰਾ ਦੇ ਉੱਪਰ ਧਿਆਨ ਦਿਓ ਡਾਇਟ ਅੱਛੀ ਖਾਵਾਂਗੇ ਤਾਂ ਇਹ ਚੀਜ਼ਾਂ ਨਹੀਂ ਬਿਮਾਰੀਆਂ ਹੋਣਗੀਆਂ ਇਮਊਨਿਟੀ ਸਿਸਟਮ ਸਟਰੋਂਗ ਹੋਏਗਾ ਦੈਟਸ ਇੱਟ